ਗਾਉਣ ਲਈ ਸਾਡੇ ਕੋਲ ਬਹੁਤ ਹੀ ਮਨਪਸੰਦ ਗੀਤ ਹਨ ਅਤੇ ਮੈਨੂੰ ਲੇਕਿਨ ਸਭ ਤੋਂ ਜੋ ਚੰਗਾ ਲੱਗਦਾ ਹੈ ਉਹ ਪੰਜਾਬ 'ਚ ਪੰਜਾਬ ਨੂੰ ਦੱਸਣ ਲਈ ਬਹੁਤ ਹੀ ਵਧੀਆ ਗੀਤ ਹੈ ਉਹਦਾ ਬੋਲ ਹਨ

ਇਸਨੂੰ ਪੰਜਾਬ ਦੇ ਅੰਦਰ ਪੰਜਾਬ ਨੂੰ ਦੱਸਿਆ ਗਿਆ ਹੈ ਕਿ ਪੰਜਾਬ 'ਚ ਕਿੰਨਾ ਰੰਗੀਨ ਕਿੰਨਾ ਖੁਸ਼ਮਿਜ਼ਾਜ ਸ ਸਮਾਜ ਹੈ ਇੱਥੇ ਮਾਵਾਂ ਨੂੰ ਰੱਬ ਮੰਨਿਆ ਗਿਆ ਕਿ ਮਾਵਾਂ ਆਪਣੇ ਬੱਚਿਆਂ ਲਈ ਅਤੇ ਸਾਰਿਆਂ ਲਈ ਕਿੰਨਾ ਕੁਛ ਕਰ ਜਾਂਦੀ ਹੈ ਤਾਂ ਇਹ ਕਹਿੰਦੇ ਰੰਗਲਾ ਪੰਜਾਬ ਅਤੇ ਸਿਫ਼ਤ ਸੁਣਾਵਾਂ ਇੱਥੇ ਰੱਬ ਵਰਗੀਆਂ ਮਾਵਾਂ ਧਰਤੀ ਪੰਜ ਦਰਿਆ ਦੀ ਰਾਣੀ ਜੋ ਧਰਤੀ ਸਾਡੀ ਪੰਜਾਬ ਦੀ ਉੱਥੇ ਪੰਜ ਦਰਿਆ ਬੜੇ ਹੀ ਅੱਛੇ ਤਰੀਕੇ ਨਾਲ ਵਗਦੇ ਹਨ ਜਿਹਦੇ ਦਾ ਨਾਮ ਉਹਨਾਂ ਦਾ ਸਤਲੁਜ ਹੈ ਬਿਆਸ ਰਾਵੀ ਚਨਾਵ ਜੇਹਲਮ ਆਹ ਪੰਜਾਬ ਦੇ ਬੜੇ ਫੇਮਸ ਹੈਗੇ ਆ ਇਹਤੋਂ ਸਾਨੂੰ ਅੰਮ੍ਰਿਤ ਵਰਗਾ ਪਾਣੀ ਮਿਲਦਾ ਹੈ ਆਹ ਸਾਡੇ ਲਈ ਬਹੁਤ ਵੱਡੀ ਉਪਲਬੱਧੀ ਹੈ